ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਟੈਕਨੋਲਜੀ ਨੇ ਕਾਫੀ ਸਾਡੀ ਮਦਦ ਕੀਤੀ ਹੈ ਜਿਸ ਤਰ੍ਹਾਂ ਅਸੀਂ ਔਨਲਾਈਨ ਇੰਟਰਨੈੱਟ ਦੀ ਗੱਲ ਕਰੀਏ ਜਿਸ ਤਰ੍ਹਾਂ ਕੋਵਿਡ ਦਾ ਟਾਈਮ ਆਇਆ ਸੀ ਬੱਚਿਆਂ ਲਈ ਸਕੂਲ ਬੰਦ ਹੋ ਗਏ ਸੀ ਅਤੇ ਔਨਲਾਈਨ ਹੋ ਕੇ ਬੱਚਿਆਂ ਨੇ ਆਪਣੀਆਂ ਕਲਾਸਾਂ ਲਗਾਈਆਂ ਮੈਡਮਾਂ ਨੇ ਉੱਥੋਂ ਪੜ੍ਹਾਇਆ ਲਿਖਾਇਆ ਔਨਲਾਈਨ ਕਲਾਸ ਦਿੱਤੀ ਇਸ ਟੈਕਨੋਲਜੀ ਦੇ ਨਾਲ ਬੱਚਿਆਂ ਨੂੰ ਪੜ੍ਹਾਈ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਅਤੇ ਅਗਰ ਹੁਣ ਅਸੀਂ ਗੱਲ ਕਰੀਏ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਕੇ ਪੜ੍ਹਨ ਦੀ ਇਸ ਟੈਕਨੋਲਜੀ ਦੇ ਨਾਲ ਉਹ ਵੀ ਟਾਈਮ ਸਾਡਾ ਬਚਦਾ ਬੱਚੇ ਔਨਲਾਈਨ ਕਲਾਸਾਂ ਲਗਾ ਕੇ ਜੋ ਦੂਰ ਬੈਠੇ ਨੇ ਅਗਰ ਕਿਸੇ ਕੰਮ ਕਰਕੇ ਉਹ ਨਹੀਂ ਆ ਸਕਦੇ ਕਿਸੇ ਪ੍ਰੋਬਲਮ ਕਰਕੇ ਉਹ ਯੂਨੀਵਰਸਿਟੀ ਜਾਂ ਆਪਣੀ ਕਲਾਸ ਦੇ ਵਿੱਚ ਨਹੀਂ ਪਹੁੰਚ ਸਕਦੇ ਉਹ ਔਨਲਾਈਨ ਕਲਾਸ ਲੈ ਕੇ ਆਪਣੀ ਸਟੱਡੀ ਕੰਪਲੀਟ ਕਰ ਸਕਦੇ ਨੇ ਅਤੇ ਔਨਲਾਈਨ ਦਾਖਲਾ ਵੀ ਅੱਜ ਕੱਲ੍ਹ ਇੱਕ ਹਿਸਾਬ ਦਾ ਟੈਕਨੋਲਜੀ ਦਾ ਪਾਰਟ ਹੈ ਤੁਸੀਂ ਆਪਣਾ ਸਮੇਂ ਬਚਾ ਸਕਦੇ ਹੋ ਆਪਣਾ ਔਨਲਾਈਨ ਤੁਸੀਂ ਫਿਲ ਕਰ ਦਿਉ ਫਾਮ ਅਤੇ ਤੁਹਾਡੀ ਐਡਮਿਸ਼ਨ ਕਿਤੇ ਵੀ ਹੋ ਸਕਦੀ ਹੈ ਜੋ ਕਿ ਬਹੁਤ ਵਧੀਆ ਚੀਜ਼ ਹੈ ਧੰਨਵਾਦ